ਮੈਂ ਤਸਵੀਰਾਂ ਖਿੱਚਣ ਲਈ ਬਹੁਤ ਹੀ ਜ਼ਿਆਦਾ ਜਗ੍ਹਾਂ ਉੱਤੇ ਘੁੰਮੀ ਹੋਈ ਹਾਂ ਚਾਹੇ ਪਹਾੜੀ ਇਲਾਕਾ ਹੋਵੇ ਜਾਂ ਫਿਰ ਆਪਣੇ ਆਸ ਪਾਸ ਦਾ ਹੋਵੇ ਜੇਕਰ ਮੈਂ ਆਪਣੇ ਆਸ ਪਾਸ ਦੇ ਖੇਤਰਾਂ ਦੀ ਗੱਲ ਕਰਾਂ ਤਾਂ ਚੰਡੀਗੜ੍ਹ ਵਿੱਚ ਬਹੁਤ ਹੀ ਜ਼ਿਆਦਾ ਥਾਵਾਂ ਹਨ ਜਿਵੇਂ ਕਿ ਰੋਜ਼ ਗਾਰਡਨ ਰੋਕ ਗਾਰਡਨ ਸੁਖਨਾ ਝੀਲ ਅਤੇ ਬਰਡ ਪਾਰਕ ਮੋਹਾਲੀ ਜ਼ਿਲ੍ਹੇ ਵਿੱਚ ਵੀ ਆਰ ਮੋਲ ਹੈ ਇਸ ਲਈ ਮੈਨੂੰ ਇਹਨਾਂ ਥਾਵਾਂ ਉੱਤੇ ਜਾ ਕੇ ਤਸਵੀਰਾਂ ਖਿੱਚਣ ਨਾਲ ਬਹੁਤ ਹੀ ਜ਼ਿਆਦਾ ਪਸੰਦ ਹੈ ਸੁਖਨਾ ਲੇਖ ਦੀ ਗੱਲ ਕਰੀਏ ਤਾਂ ਉੱਥੇ ਬਹੁਤ ਹੀ ਜ਼ਿਆਦਾ ਸ਼ਾਂਤੀ ਹੈ ਅਤੇ ਉੱਥੇ ਬਹੁਤ ਹੀ ਜ਼ਿਆਦਾ ਲੋਕ ਘੁੰਮਣ ਲਈ ਆਉਂਦੇ ਰਹਿੰਦੇ ਹਨ ਇਸ ਤੋਂ ਇਲਾਵਾ ਰੋਕ ਗਾਰਡਨ ਦੀ ਗੱਲ ਕਰੀਏ ਤਾਂ ਉਹ ਥਾਂ ਪੁਰਾਣੀਆਂ ਟੁੱਟੀਆਂ ਫੁੱਟੀਆਂ ਚੀਜ਼ਾਂ ਦੀ ਬਣੀ ਹੋਈ ਹੈ ਜਿਸਦੀਆਂ ਤਸਵੀਰਾਂ ਖਿੱਚਣਾ ਮੈਨੂੰ ਬਹੁਤ ਹੀ ਜ਼ਿਆਦਾ ਪਸੰਦ ਹੈ ਰੋਜ਼ ਗਾਰਡਨ ਦੀ ਗੱਲ ਕਰੀਏ ਤਾਂ ਉੱਥੇ ਅਲੱਗ ਅਲੱਗ ਸਮੇਂ ਉੱਤੇ ਵੱਖ ਵੱਖ ਤਰ੍ਹਾਂ ਦੇ ਫੁੱਲ ਉੱਗਦੇ ਰਹਿੰਦੇ ਹਨ ਓਥੇ ਇੱਕ ਖਾਸ ਰੋਜ਼ ਫੈਸਟ ਵੀ ਲੱਗਦਾ ਹੈ ਜਿੱਥੇ ਬਹੁਤ ਹੀ ਦੂਰ ਦੂਰ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਅਲੱਗ ਅਲੱਗ ਕਿਸਮ ਦੇ ਫੁੱਲ ਆਉਂਦੇ ਹਨ ਇਸ ਤੋਂ ਇਲਾਵਾ ਵੀ ਆਰ ਮੋਲ ਦੀ ਗੱਲ ਕਰੀਏ ਤਾਂ ਮੈਨੂੰ ਦੋਸਤਾਂ ਨਾਲ਼ ਯਾ ਪਰਿਵਾਰ ਦੇ ਮੈਂਬਰਾਂ ਨਾਲ਼ ਉੱਥੇ ਜਾ ਕੇ ਫੋਟੋਆਂ ਖਿੱਚਣਾ ਬਹੁਤ ਜ਼ਿਆਦਾ ਪਸੰਦ ਹੈ ਉੱਥੇ ਤਸਵੀਰਾਂ ਖਿੱਚਣ ਲਈ ਬਹੁਤ ਹੀ ਵਧੀਆ ਵਧੀਆ ਜਗ੍ਹਾ ਬਣਾਈਆਂ ਹੋਈਆਂ ਹਨ